ਪੰਜਾਬ ਵਿੱਚ ਹਰ ਇੱਕ ਤਰ੍ਹਾਂ ਦਾ ਮੌਸਮ ਹੈ ਅਤੇ ਸਾਡੇ ਖੇਤਰ ਵਿੱਚ ਵੀ ਜੋ ਅਲੱਗ ਅਲੱਗ ਮੌਸਮਾਂ ਵਿੱਚ ਅਲੱਗ ਅਲੱਗ ਫਸਲਾਂ ਹੁੰਦੀਆਂ ਹਨ ਜਿਵੇਂ ਕਿ ਸਰਦੀਆਂ ਦੇ ਵਿੱਚ ਜਦੋਂ ਸਰਦੀਆਂ ਦੀ ਸ਼ੁਰੂਆਤ ਹੁੰਦੀ ਹੈ ਉਦੋਂ ਅਸੀਂ ਕਣਕ ਲਗਾਉਂਦੇ ਹਾਂ ਅਤੇ ਜਦੋਂ ਗਰਮੀ ਦਾ ਮੌਸਮ ਸਟਾਰਟ ਹੁੰਦਾ ਹੈ ਉਸ ਤੋਂ ਪਹਿਲਾਂ ਉਸ ਦੀ ਵਾਢੀ ਕਰਕੇ ਉਸ ਤੋਂ ਬਾਅਦ ਅਸੀਂ ਝੋਨੇ ਦੀ ਫਸਲ ਲਗਾਉਂਦੇ ਹਾਂ ਅਤੇ ਜਦੋਂ ਸਰਦੀਆਂ ਦੇ ਮੌਸਮ ਵਿੱਚ ਅਸੀਂ ਆਲੂਆਂ ਦੀ ਫਸਲ ਵੀ ਲਗਾਉਂਦੇ ਹਾਂ ਅਤੇ ਹਰੇਕ ਫਸਲ ਲਈ ਅਲੱਗ ਅਲੱਗ ਸਮਾਂ ਬਣਿਆ ਹੋਇਆ ਹੈ